ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾ ਬਹੁਤ ਮੁਸ਼ਕਿਲ ਆ ਉਹਨਾਂ ਲਈ ਤਾਂ ਵਿਚਾਰੇ ਪਿੰਡ ਤੋਂ ਚੱਲ ਕੇ ਸ਼ਹਿਰ ਨੂੰ ਆਉਂਦੇ ਆ ਇੰਨੀ ਦੂਰੋਂ ਆਉਂਦੇ ਆ ਅਤੇ ਉਹਨਾਂ ਨੂੰ ਐਈਂ ਨਹੀਂ ਪਤਾ ਹੁੰਦਾ ਕਿ ਵਕੀਲ ਕਿੱਥੇ ਬੈਠਾ ਹੈ ਕਿੱਥੇ ਸਾਡੀ ਸੁਣਵਾਈ ਹੋਣੀ ਹੈ ਕਿੱਥੇ ਅਦਾਲਤ ਲੱਗਣੀ ਹੈ ਉਹ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਵਿਚਾਰੇ ਸੋਚੋ ਹੀ ਨਾ ਪੇਂਡੂ ਲੋਕਾਂ ਨੂੰ ਇੱਥੋਂ ਤੱਕ ਕਿ ਉਹਨਾਂ ਨੂੰ ਫਾਰਮ ਤੱਕ ਵੀ ਨਹੀਂ ਕੋਈ ਭਰਨਾ ਆਉਂਦਾ ਹੈਗਾ ਵੀ ਕਿ ਕਿੱਦਾਂ ਭਰਨਾ ਕੀ ਕਰਨਾ ਹੈ ਕੀ ਨਹੀਂ ਕਰਨਾ ਕੀ ਸਲਾਹ ਲੈਣੀ ਹੈ ਕਿਸੇ ਤੋਂ ਕੀ ਨਹੀਂ ਲੈਣੀ ਪੁਲਿਸ ਸਟੇਸ਼ਨਾਂ ਦੇ ਉੱਤੇ ਧੱਕੇ ਖਾ ਖਾ ਕਚਹਿਰੀਆਂ 'ਚ ਧੱਕੇ ਖਾ ਖਾ ਵਿਚਾਰੇ ਹੰਬ ਜਾਂਦੇ ਹੈ ਇੰਨੀ ਮੁਸ਼ਕਿਲ ਪੈਦਾ ਹੁੰਦੀ ਹੈ ਉਹਨਾਂ ਨੂੰ ਵਕੀਲ ਇੱਥੋਂ ਤੱਕ ਉਹਨਾਂ ਨੂੰ ਆਪਦੀ ਪ੍ਰੋਪਰਟੀ ਦਾ ਕੋਈ ਕੰਮ ਕਰਾਉਣਾ ਹੋਵੇ ਤਾਂ ਵੀ ਮੁਸ਼ਕਿਲ ਆਉਂਦੀ ਹੈ